ਹਾਂਜੀ ਸਾਡੇ ਨੇੜੇ ਇੱਕ ਜਗ੍ਹਾ ਹੈ ਜਿਹਨੂੰ ਆਪਾਂ ਤਰਿਉਂਦ ਕਹਿੰਦੇ ਹਾਂ ਜੋ ਕਿ ਸਾਡੇ ਸ਼ਹਿਰ ਤੋਂ ਡੇਢ ਸੌ ਕੁ ਡੇਢ ਸੌ ਦੋ ਸੌ ਕਿਲੋਮੀਟਰ ਦੂਰ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਅਤੇ ਅਸੀਂ ਕਈ ਵਾਰ ਉਸ ਜਗ੍ਹਾ ਦੇ ਉੱਤੇ ਹਾਈਕਿੰਗ ਕਰਨ ਗਏ ਹਾਂ ਉੱਥੇ ਜਾਣ ਲਈ ਰਾਹ ਵੀ ਬਣਿਆ ਹੋਇਆ ਹੈ ਇੱਕ ਧਰ ਤੱਕ ਜਾ ਕੇ ਅੱਗੇ ਪਾਰਕਿੰਗ ਤੋਂ ਬਾਅਦ ਅੱਗੇ ਗੱਡੀ ਨਹੀਂ ਜਾ ਸਕਦੀ ਉਸ ਤੋਂ ਬਾਅਦ ਦੋ ਢਾਈ ਘੰਟੇ ਦਾ ਸਿੱਧਾ ਚੜ੍ਹਾਈ ਦੀ ਰਾ ਚੜ੍ਹਾਈ ਦਾ ਰਾਹ ਹੈ ਚੜ੍ਹਾਈ ਕਰਦੇ ਕਰਦੇ ਅਸੀਂ ਜਦੋਂ ਉੱਤੇ ਪਹੁੰਚਦੇ ਹਾਂ ਤਾਂ ਉੱਥੇ ਪਹੁੰਚ ਕੇ ਸਾਹਮਣੇ ਇੱਕ ਗਲੇਸ਼ੀਅਰ ਦਿੱਸਦਾ ਹੈ ਜਿਸਨੂੰ ਦੇਖ ਕੇ ਬਹੁਤ ਮਨ ਮੋਹ ਦਾ ਹੈ ਵਾਪਿਸ ਆਉਂਦੇ ਹੋਏ ਮਕਲੋੜਗੰਜ ਅਤੇ ਧਰਮਸ਼ਾਲਾ ਸ਼ਹਿਰ ਘੁੰਮ ਕੇ ਅਸੀਂ ਇੱਕ ਦਿਨ ਦੇ ਵਿੱਚ ਪੂਰੀ ਟਰੈਕਿੰਗ ਕਰਕੇ ਵਾਪਿਸ ਆਪਣੇ ਸ਼ਹਿਰ ਵਾਪਿਸ ਆ ਸਕਦੇ ਹਾਂ ਅਸੀਂ ਇਹ ਟਰੈਕਿੰਗ ਦਾ ਰਾਹ ਕਾਫ਼ੀ ਵਾਰ ਗਏ ਹਨ ਅਤੇ ਸਾਨੂੰ ਹਮੇਸ਼ਾ ਜਾ ਕੇ ਅੱਛਾ ਲੱਗਦਾ ਹੈ